ਕੀ ਸਾਡਾ ਕੋਈ ਘਰ ਸ਼ਮਸ਼ਾਨ ਘਾਟ ਵਾਲੀ ਗਲੀ 'ਚ ਸੀਗਾ ਇੱਕ ਦਿਨ ਕੀ ਅਸੀਂ ਦੇਖਿਆ ਕਿ ਕੀ ਇੱਕ ਸ਼ੂਟਿੰਗ ਜੋ ਕਿ ਸ਼ੂਟਿੰਗ ਵਾਸਤੇ ਜਾ ਰਹੇ ਸੀਗੇ ਅਤੇ ਉਹਨਾਂ ਦੇ ਅ ਮੋਢਿਆਂ ਉੱਤੇ ਇੱਕ ਅਰਥੀ ਚੁੱਕੀ ਹੋਈ ਸੀਗੀ ਕਿ ਮਗਰ ਦੁਨੀਆ ਵੀ ਬਹੁਤ ਸੀਗੀ ਅਸੀਂ ਸੋਚਿਆ ਵੀ ਕੀ ਇਹ ਸੱਚ ਦਾ ਸੰਸਕਾਰ ਜਾ ਰਿਹਾ ਹੈਗਾ ਕੀ ਜੋ ਸੰਸਕਾਰ ਲੈ ਕੇ ਜਾ ਰਹੇ ਜੋ ਅਰਥੀ ਲੈ ਕੇ ਜਾ ਰਹੇ ਸੀ ਅਤੇ ਮਗਰ ਇੱਕ ਭਾਈ ਦੇ ਹੱਥ ਵਿੱਚ ਘੜਾ ਵੀ ਫੜਿਆ ਫੜਿਆ ਹੋਇਆ ਸੀ ਜੋ ਕਿ ਉਸ ਨੂੰ ਇਹ ਕਹਿੰਦੇ ਨੇ ਵੀ ਘੜਾ ਭੰਨ ਘੜਾ ਭੰਨਣ ਦੀ ਰੀਤੀ ਰਿਵਾਜ਼ ਜੋ ਕਿ ਕੀਤਾ ਜਾਂਦਾ ਹੈ ਅਸੀਂ ਕੁਛ ਦੇਰ ਤਾਂ ਦੇਖਦੇ ਰਹੇ ਦੇਖਦੇ ਦੇਖਦੇ ਅਸੀਂ ਸੋਚਿਆ ਵੀ ਚੱਲੋ ਕਿ ਆਪਾਂ ਵੀ ਚੱਲੀਏ ਦੇਖੀਏ ਵੀ ਕੌਣ ਹੈ ਕਿ ਉਹ ਕੀ ਸਾਨੂੰ ਜੋ ਦੂ ਲੋਕ ਸੀ ਕੁਝ ਲੋਕ ਸੀ ਸਾਡੇ ਮੁਹੱਲੇ ਦੇ ਸੀਗੇ ਅਸੀਂ ਕੁਛ ਦੇਰ ਤਾਂ ਦੇਖਦੇ ਰਹੇ ਦੇਖਦੇ ਰਹੇ ਫਿਰ ਅਸੀਂ ਜਦੋਂ ਕਿ ਅਸੀਂ ਮਗਰ ਗਏ ਕੁਛ ਦੇਰ ਵਾਸਤੇ ਤਾਂ ਸਾਨੂੰ ਨਹੀਂ ਸਮਝ ਲੱਗੀ ਜਦੋਂ ਕਿ ਸਮਝ ਲੱਗੀ ਅਤੇ ਅਸੀਂ ਕਿਸੇ ਨੂੰ ਪੁੱਛਿਆ ਵੀ ਇੱਥੇ ਕੀ ਹੋ ਰਿਹਾ ਇੱਕ ਦੂਜੇ ਨੂੰ ਪੁੱਛਿਆ ਲਿਆ ਵੀ ਇੱਥੇ ਕੀ ਹੋ ਰਿਹਾ ਹੈ ਵੀ ਕੀ ਇੱਥੇ ਕੀ ਹੋਇਆ ਕੀ ਹੋ ਰਿਹਾ ਸ਼ਮਸ਼ਾਨ ਘਰ ਦੇ ਵਿੱਚ ਵੀ ਸੰਸਕਾਰ ਆਇਆ ਕੋਈ ਕਹੇ ਸੰਸਕਾਰ ਆਇਆ ਹੈ ਕੋਈ ਕਹਿੰਦਾ ਸੀਗਾ ਮੈਂ ਨਹੀਂ ਇਹ ਵੀ ਐਕਟਰ ਹੈ ਵੀ ਇਹ ਆਪਣੀ ਫਿਲਮ ਦੀ ਸ਼ੂਟਿੰਗ ਕਰੀ ਜਾਂਦਾ ਜਦੋਂ ਕਿ ਅਸੀਂ ਅੱਗੇ ਜਾ ਕੇ ਦੇਖਿਆ ਕੁਝ ਲੋਕ ਜ਼ੋਰ ਜ਼ੋਰ ਦੀ ਹੱਸੀ ਜਾ ਰਹੇ ਸੀਗੇ ਪਰ ਸਾਨੂੰ ਕੋਈ ਸਮਝ ਨਹੀਂ ਸੀ ਆ ਰਹੀ ਵੀ ਸ਼ਮਸ਼ਾਨਾਂ ਦੇ ਵਿੱਚ ਕੀ ਹੋ ਰਿਹਾ ਹੈ ਜੋ ਕਿ ਰੀਤੀ ਰਿਵਾਜ਼ ਸਮਸ਼ਾਨ 'ਚ ਸੰਸਕਾਰ ਤਾਂ ਹੁੰਦਾ ਅਤੇ ਅਸੀਂ ਉਹਨੂੰ ਦੇਖਿਆ ਕਿ ਉਹ ਸ਼ੂਟਿੰਗ ਕਰ ਰਹੇ ਸੀ ਅਤੇ ਸ਼ੂਟਿੰਗ ਕਰਦੇ ਹੋਏ ਕੋਈ ਅਸੀਂ ਵੀ ਉੱਥੇ ਖੜ੍ਹ ਕੇ ਦੇਖਿਆ ਕੁਝ ਖੜ੍ਹ ਕੇ ਦੇਖਿਆ ਕੋਈ ਰੋਣ ਦੀ ਆਵਾਜ਼ ਕੱਢ ਰਿਹਾ ਸੀ ਕੋਈ ਜ਼ੋਰ ਜ਼ੋਰ ਦੀ ਹੱਸ ਰਿਹਾ ਸੀਗਾ ਇਸ ਕਾਰਣ ਦੇਖ ਕੇ ਸਾਨੂੰ ਇਹ ਦੇਖਣ ਨੂੰ ਮਿਲਿਆ ਵੀ ਇਹ ਕੀ ਸ਼ੂਟਿੰਗ ਕਰ ਰਹੇ ਨੇਗੇ ਅਤੇ ਅਸੀਂ ਉੱਥੇ ਸ਼ੂਟਿੰਗ ਹੁੰਦਿਆਂ ਹੋਇਆ ਦੇਖਿਆ